ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਹੜੀ ਆਪਾਂ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਰਸੋਈ ਘਰ ਵਿੱਚ ਕਰਦੇ ਹਾਂ ਤਾਂ ਉਹਦੀ ਵਰਤੋਂ ਕਰਦੇ ਸਮੇਂ ਸਾਨੂੰ ਕਿਹੋ ਜਿਹੀਆਂ ਸੁਰੱਖਿਆ ਸਾਵਧਾਨੀਆਂ ਦਾ ਜਿਹੜਾ ਵਾ ਉਹ ਧਿਆਨ ਰੱਖਣਾ ਚਾਹੀਦਾ ਵਾ ਜਾਂ ਵਰਤਣੀਆਂ ਚਾਹੀਦੀਆਂ ਨੇ ਉਹਦੇ ਵਾਸਤੇ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਸਿਲੰਡਰ ਨੂੰ ਗੈਸ ਚੁੱਲ੍ਹੇ ਨਾਲ ਜੋੜਦੇ ਹਾਂ ਤਾਂ ਉਹਨੂੰ ਜੋੜਨ ਵਾਸਤੇ ਇੱਕ ਪਾਈਪ ਅਤੇ ਰੈਗੂਲੇਟਰ ਦੀ ਜ਼ਰੂਰਤ ਪੈਂਦੀ ਹੈ ਅਤੇ ਸਾਨੂੰ ਵੇਖਣਾ ਚਾਹੀਦਾ ਹੈ ਕਿ ਉਹ ਰੈਗੂਲੇਟਰ ਸਹੀ ਤਰ੍ਹਾਂ ਕੰਮ ਕਰਦਾ ਵਾ ਜਿਹੜੀ ਉਹ ਪਾਈਪ ਆ ਉਹ ਸਹੀ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਹੈ ਠੀਕ ਹੈ ਕਿਤਿਓਂ ਕੋਈ ਹ ਗੈਸ ਤਾਂ ਨਹੀਂ ਨਿਕਲਦੀ ਕਿਤਿਓਂ ਕੋਈ ਲੀਕ ਤਾਂ ਨਹੀਂ ਹੁੰਦਾ ਠੀਕ ਹੈ ਜੇਕਰ ਤੁਹਾਨੂੰ ਕੋਈ ਸ਼ੱਕ ਹੁੰਦਾ ਵਾ ਕਿ ਗੈਸ ਦੀ ਜ਼ਿਆਦਾ ਸਮੈੱਲ ਆਉਣ ਡਈ ਆ ਕਿਤਿਓਂ ਕੁਝ ਲੀਕ ਹੋਣ ਡਿਆ ਤਾਂ ਤੁਰੰਤ ਜਿਹੜਾ ਵਾ ਉਹਨੂੰ ਚੈੱਕ ਕਰ ਕੇ ਉਹਦੀ ਰਿਪੇਅਰ ਕਰਵਾ ਕੇ ਫਿਰ ਜਿਹੜਾ ਵਾ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਅਣਗਹਿਲੀ ਨਹੀਂ ਕਰਨੀ ਚਾਹੀਦੀ ਦੂਸਰਾ ਜਦੋਂ ਆਪਾਂ ਗੈਸ ਚੁੱਲ੍ਹੇ ਨੂੰ ਚਲਾਉਂਦੇ ਹਾਂ ਚਲਾਉਣ ਲਈ ਜੇ ਤਾਂ ਅਸੀਂ ਲਾਈਟਰ ਦੀ ਵਰਤੋਂ ਕਰਦੇ ਹਾਂ ਤਾਂ ਠੀਕ ਹੈ ਪਰ ਜੇਕਰ ਅਸੀਂ ਤੀਲਾਂ ਵਾਲੀ ਡੱਬੀ ਦੀ ਵਰਤੋਂ ਕਰਦੇ ਹਾਂ ਤਾਂ ਤੀਲ ਨੂੰ ਜਲਾ ਕੇ ਗੈਸ ਚਲਾਉਣ ਤੋਂ ਬਾਅਦ ਉਹਨੂੰ ਸਹੀ ਤਰੀਕੇ ਨਾਲ ਬੁਝਾ ਕੇ ਅਤੇ ਉਹਦੀ ਤੀਲੀ ਨੂੰ ਬੁਝੀ ਹੋਈ ਜਲੀ ਹੋਈ ਤੀਲੀ ਨੂੰ ਇੱਕ ਸਾਈਡ 'ਤੇ ਰੱਖਣਾ ਚਾਹੀਦਾ ਇਹ ਨਹੀਂ ਕਿ ਉਹਨੂੰ ਤੀਲੀ ਨੂੰ ਅਸੀਂ ਜਿਹੜਾ ਵਾ ਅੱਗ ਨਾਲ ਗੈਸ ਨੂੰ ਜਲਾਇਆ ਅਤੇ ਅੱਗ ਲਗਾਈ ਤਾਂ ਉਹਨੂੰ ਤੀਲੀ ਨੂੰ ਅਸੀਂ ਜਲਦਾ ਹੀ ਸੁੱਟ ਦਿੱਤਾ ਉਹ ਕਈ ਵਾਰ ਦੁਰਘਟਨਾ ਦਾ ਕਾਰਨ ਬਣ ਸਕਦੀ ਇਸ ਤੋਂ ਇਲਾਵਾ ਵੇਖੋ ਜਦੋਂ ਆਪਾਂ ਜਿੰਨਾ ਟਾਈਮ ਤਾਂ ਆਪਾਂ ਚੁੱਲ੍ਹੇ ਦੀ ਗੈਸ ਦੀ ਵਰਤੋਂ ਕਰਦੇ ਪਏ ਹਾਂ ਠੀਕ ਆ ਅਤੇ ਜਦੋਂ ਅਸੀਂ ਰਾਤ ਨੂੰ ਬੰਦ ਕਰਕੇ ਰਸੋਈ ਘਰ ਨੂੰ ਠੀਕ ਹੈ ਜਾਂਦੇ ਹਾਂ ਤਾਂ ਸਾਨੂੰ ਸਭ ਤੋਂ ਜ਼ਰੂਰੀ ਹੈ ਕਿ ਉਹ ਜਦੋਂ ਸਿਲੰਡਰ ਜਿਹੜਾ ਹੁੰਦਾ ਉਹਦੇ ਉੱਤੇ ਜਿਹੜਾ ਰੈਗੂਲੇਟਰ ਜਿਹੜਾ ਲੱਗਿਆ ਹੁੰਦਾ ਉਹਦੇ ਨਾਲ ਇੱਕ ਛੋਟਾ ਜਿਹਾ ਜਿਹੜਾ ਵਾ ਉਹ ਬਲੈਕ ਕਲਰ ਦਾ ਅ ਕਾਲੇ ਰੰਗ ਦਾ ਇੱਕ ਸਵਿੱਚ ਜਿਹਾ ਹੁੰਦਾ ਵਾ ਉਹ ਬਟਨ ਨੂੰ ਘੁੰਮਾ ਕੇ ਅਤੇ ਉਹ ਗੈਸ ਨੂੰ ਜਿਹੜਾ ਵਾ ਥੱਲੇ ਤੋਂ ਬੰਦ ਕਰਕੇ ਜਾਣਾ ਚਾਹੀਦਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਦੁਰਘਟਨਾ ਹੋਣ ਦਾ ਕਾਰਨ ਜਿਹੜਾ ਵਾ ਉਹ ਟਲ ਜਾਵੇ ਕੋਈ ਦੁਰਘਟਨਾ ਨਾ ਹੋਵੇ ਕਿਉਂਕਿ ਕਈ ਵਾਰ ਘਰ ਵਿੱਚ ਕੋਈ ਚੂਹੇ ਚਾਹੇ ਜਾਂ ਕੁਛ ਹੋਰ ਇੱਦਾਂ ਦਾ ਕੁਝ ਜਿਹੜਾ ਕੱਟ ਸਕੇ ਪਾਈਪ ਨੂੰ ਅਤੇ ਜਿਹੜੀ ਗੈਸ ਆ ਉਹ ਲੀਕ ਨਾ ਹੋਵੇ ਠੀਕ ਹੈ ਇਹਨਾਂ ਤੋਂ ਜਿਹੜਾ ਵਾ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਰੱਖ ਕੇ ਆਪਾਂ ਜਿਹੜਾ ਵਾ ਆਪਣੀ ਜ਼ਿੰਦਗੀ ਨੂੰ ਸੁਰੱਖਸ਼ਿਤ ਕਰ ਸਕਦੇ ਹਾਂ ਅਤੇ ਇੱਦਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਵਾ ਬੱਚਿਆਂ ਦੀ ਪਹੁੰਚ ਤੋਂ ਥੋੜ੍ਹਾ ਜਿਹਾ ਦੂਰ ਰੱਖਣਾ ਚਾਹੀਦਾ ਬੱਚਿਆਂ ਨੂੰ ਕੋਈ ਵੀ ਇਹ ਜਿਵੇਂ ਕਰਦ ਵਗੈਰਾ ਕੁਛ ਵੀ ਕਈ ਵਾਰ ਬੱਚੇ ਲੈ ਕੇ ਅਤੇ ਚੀਜ਼ਾਂ ਨੂੰ ਕੱਟਣ ਦੀ ਆਦਤ ਹੁੰਦੀ ਧਿਆਨ ਰੱਖਣਾ ਚਾਹੀਦਾ ਕਿ ਕਿਤੇ ਜਾਣੇ ਅਣਜਾਣੇ ਵਿੱਚ ਬੱਚੇ ਉਹ ਪਾਈਪ ਦੇ ਲਾਗੇ ਤਾਂ ਨਹੀਂ ਚਲੇ ਗਏ ਕਿਤੇ ਉਹਨਾਂ ਨੇ ਉੱਥੇ ਕੋਈ ਕੱਟ ਤਾਂ ਨਹੀਂ ਲਾ ਤਾ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਵਾ ਉਹ ਸੁਰੱਖਸ਼ਿਤ ਕਰ ਸਕਦੇ ਹਾਂ ਧੰਨਵਾਦ